ਹਾਂਜੀ ਮੈਂ ਪਾਸਪੋਰਟ ਆਫਿਸ ਤੋਂ ਬੋਲ ਰਹਾ ਹੂ ਹਾਂਜੀ ਹਾਂਜੀ ਹਾਂਜੀ ਬੋਲੋ ਸਰ ਹਾਂਜੀ ਹਾਂਜੀ ਉਹ ਤਾਂ ਜਰੂਰੀ ਐ ਜੀ ਹਾਂਜੀ ਹਾਂਜੀ ਹਾਂਜੀ ਪੰਕਜ ਤੁਸੀਂ ਪੰਜਾਬ ਤੇ ਬੋਲ ਰਹੇ ਹੋ ਕਿਹੜੀ ਸਿਟੀ ਐ ਜੀ ਕਿਹੜੀ ਸਿਟੀ ਫਾਜਿਲਕਾ ਤੋਂ ਹਾਂਜੀ ਜੀ ਮੈਂ ਜੀ ਮੇਨ ਜਿਹੜਾ ਪਾਸਪੋਰਟ ਆਫਿਸ ਆਪਣਾ ਦਿੱਲੀ ਤੋਂ ਬੋਲ ਰਿਹਾ ਜੀ ਮੈਂ ਤੇ ਜਿੱਥੇ ਤੱਕ ਮੈਂ ਤੁਹਾਡਾ ਹੁਣ ਚੈੱਕ ਕਰ ਪਾ ਰਿਹਾ ਆਪਣੇ ਕੰਪਿਊਟਰ 'ਚ ਤੇ ਉਹ ਬੋਲ ਰਿਹਾ ਕਿ ਅੰਮ੍ਰਿਤਸਰ ਹੁੰਦਾ ਜੀ ਤੁਹਾਡਾ ਇਹ ਕੰਮ ਸਾਰਾ ਅੰਮ੍ਰਿਤਸਰ ਹੁੰਦਾ ਤੇ ਜੀ ਇੱਕ ਇੱਕ ਫਿਰੋਜ਼ਪੁਰ ਦੀ ਵੀ ਦਿਖਾ ਰਿਹਾ ਵਿੱਚ ਮੈਨੂੰ ਨੀਚੇ ਨਾਮ ਉਹਦਾ ਫਿਰੋਜਪੁਰ ਵੀ ਕਹਿੰਦੇ ਫਿਰੋਜਪੁਰ ਵੀ ਹੋ ਸਕਦਾ ਤੇ ਪਰ ਫਿਰੋਜਪੁਰ ਦੀ ਵੇਟਿੰਗ ਜਿਆਦਾ ਦੱਸ ਰਿਹਾ ਜੀ ਮੈਨੂੰ ਇਧਰ ਦਾ ਫਿਰੋਜ਼ਪੁਰ ਦੀ ਵੈਟਿੰਗ ਆ ਜੀ ਘੱਟੋ ਘੱਟ ਕਹਿ ਰਿਹਾ ਦੋ ਮਹੀਨੇ ਤੱਕ ਘੱਟੋ ਘੱਟ ਮਨੀਮਮ ਦੋ ਘੰਟੇ ਦੋ ਮਹੀਨੇ ਮਤਲਬ ਸੋਰੀ ਹਾਂਜੀ ਤੇ ਅੰਮ੍ਰਿਤਸਰ ਚ ਦੱਸ ਰਿਹਾ ਜੀ ਇੱਕ ਮਹੀਨੇ ਦਾ ਦੱਸ ਰਿਹਾ ਤੇ ਇੱਕ ਮਦਾ ਹੀਨੇ ਦੱਸ ਰਿਹਾ ਹਾਂਜੀ ਹਾਂਜੀ ਸਰ ਹਾਂਜੀ ਵੇਖੋ ਜੀ ਇੱਕ ਤਾਂ ਇਹ ਆਨਲਾਈਨ ਅਪਲਾਈ ਹੁੰਦਾ ਜੀ ਆਨਲਾਈਨ ਅਪਲਾਈ ਤੁਹਾਨੂੰ ਕਰਨਾ ਪਏਗਾ ਤੁਸੀਂ ਘਰੋ ਵੀ ਕਰ ਸਕਦੇ ਹੋ ਕੋਈ ਨੈਟ ਕੈਫੇ ਤੇ ਜਾ ਕੇ ਕਿਸੇ ਤੋਂ ਵੀ ਕਰਵਾ ਸਕਦੇ ਹੋ ਤੇ ਆਨਲਾਇਨ ਅਪਲਾਈ ਹੋਏਗਾ ਜੀ ਇਹ ਠੀਕ ਐ ਜੀ ਇਹਦੀ ਫੀਸ ਮੈਂ ਤੁਹਾਨੂੰ ਦੱਸਦਾ ਜੀ ਸਤਾਰਾਂ ਸੌ ਰੁਪਏ ਫੀਸ ਹੁੰਦੀ ਐ ਜੀ ਇਹਦੀ ਸਾਰੀ ਸੌਲਾਂ ਸੌ ਸਤਾਰਾਂ ਸੌ ਸਰਕਾਰੀ ਫੀਸ ਹੈ ਜੀ ਇਹਦੀ ਠੀਕ ਐ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਅਪੁਆਇੰਟਮੈਂਟ ਮਿਲੇਗੀ ਇਹਦੀ ਆਨਲਾਈਨ ਅਪੁਆਇੰਟਮੈਂਟ ਮਿਲੇਗੀ ਤੁਹਾਡੇ ਹਿਸਾਬ ਨਾਲ ਹੀ ਮਿਲੇਗੀ ਨਾਲੇ ਕਿ ਤੁਸੀਂ ਕਦੋਂ ਫਰੀ ਹੋ ਤੁਹਾਨੂੰ ਕਦੋਂ ਟਾਈਮ ਹੈ ਵੀ ਇਹ ਨਹੀਂ ਅਸੀਂ ਆਪਣੀ ਮਰਜੀ ਨਾਲ ਦੇ ਦਾਂਗੇ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਪਰ ਥੋੜਾ ਜਿਹਾ ਮਤਲਬ ਕਹਿੰਦਾ ਤੁਸੀਂ ਆਪਦੇ ਅਕੋਰਡਿੰਗ ਵੇਖ ਵੇਖ ਕੇ ਤੇ ਕਹਿਣ ਦਾ ਮਤਲਬ ਇਹ ਕਿ ਤੁਸੀਂ ਆਪਦੇ ਅਕੋਰਡਿੰਗ ਲੈ ਸਕਦੇ ਹੋ ਜੀ ਸਾਡੇ ਵੱਲੋਂ ਕੋਈ ਉਹ ਨਹੀਂ ਹੈਗਾ ਕਿ ਤੁਸੀਂ ਉਦੋਂ ਹੀ ਜਾਣਾ ਤੁਸੀਂ ਆਪਦੇ ਵੱਲੋਂ ਲਓ ਤੇ ਅਸੀਂ ਵੇਖਾਂਗੇ ਇਧਰੋ ਸੋਫਟਵੇਅਰ 'ਚ ਸੋਫਟਵੇਅਰ ਵੇਖੇ ਗਾ ਕਿ ਕਦੋਂ ਅਵੇਲੇਬਲ ਹੈਗੇ ਆ ਤੇ ਉਸ ਦਿਨ ਤੁਹਾਨੂੰ ਬੁਲਾ ਲਿਆ ਜਾਏਗਾ ਜੀ ਡਾਕੂਮੈਂਟ ਸਾਰਾ ਆਈ ਹੁੰਦੇ ਆ ਜੀ ਮੇਨ ਤਾਂ ਆਧਾਰ ਕਾਰਡ ਆ ਜੀ ਆਧਾਰ ਕਾਰਡ ਐ ਟੈਥ ਦੀ ਜਿਹੜੀ ਡੀ ਐਮ ਸੀ ਐ ਤੇ ਇਹਨਾਂ ਦੇ ਨਾਮ ਸੇਮ ਹੋਣੀ ਚਾਹੀਦੀ ਆਪਸ ਚ ਆਧਾਰ ਕਾਰਡ ਤੇ ਡੀ ਐਮ ਸੀ ਦੇ ਫਾਦਰ ਨੇ ਤੇ ਆਪਦਾ ਤੁਹਾਡਾ ਨਾਮ ਬਿਲਕੁਲ ਸੇਮ ਹੋਣ ਇੱਕ ਇਕ ਅਕਸ਼ਰ ਮਤਲਬ ਕਹਿਣ ਦਾ ਮਤਲਬ ਬਿਲਕੁਲ ਸੇਮ ਹੋਣਾ ਚਾਹੀਦਾ ਜੀ ਤੇ ਆਧਾਰ ਕਾਰਡ ਟੈਥ ਦੀ ਡੀ ਐਮ ਸੀ ਹੋ ਗਈ ਤੇ ਪੈਨ ਕਾਰਡ ਵਗੈਰਾ ਵੈਸੇ ਆਪਸ਼ਨ ਹੁੰਦੇ ਮੈਂ ਲਗਭਗ ਤੋਂ ਉਹ ਤੁਸੀਂ ਲਾ ਸਕਦੇ ਹੋ ਨਾਲ ਤੇ ਆਹ ਹੀ ਹੁੰਦਾ ਜੀ ਮੇਨ ਤਾਂ ਬਸ ਤੇ ਇਸ ਤੋਂ ਬਾਅਦ ਤੁਹਾਨੂੰ ਜੀ ਫਿਰ ਅਪੁਆਇੰਟਮੈਂਟ ਮਿਲ ਜਾਏਗੀ ਤੁਹਾਨੂੰ ਫਿਰ ਅੰਮ੍ਰਿਤਸਰ ਜਾਣਾ ਪਏਗਾ ਜਾਂ ਫਿਰੋਜਪੁਰ ਸਲੈਕਟ ਕਰਿਆ ਤਾਂ ਫਿਰੋਜਪੁਰ ਜਾਣਾ ਪਏਗਾ ਫਿਰ ਉਸ ਤੋਂ ਬਾਅਦ ਜੀ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਏਗੀ ਇਹ ਸਭ ਸਿਸਟਮ ਆ ਜੀ ਕੋਈ ਜਿਆਦਾ ਟਫ ਨੀ ਮਤਲਬ ਹੋ ਜਾਏਗਾ ਮਤਲਬ ਔਰ ਜੀ ਹੁਣ ਤਾਂ ਵੈਸੇ ਬੜਾ ਵੇਟਿੰਗ ਚੱਲ ਰਹੀ ਬੜੀ ਲੰਬੀ ਚੱਲ ਰਹੀ ਐ ਆਹ ਕੈਨੇਡਾ ਜੀ ਕਿਉਂਕਿ ਇੰਟੇਕ ਐ ਨਾ ਅਗਲਾ ਜੀ ਤੇ ਉਹਦੇ ਚੱਕਰ ਚ ਤਾਂ ਕਈ ਵਾਰ ਮਹੀਨਾ ਵੀ ਲੱਗ ਜਾਂ ਦੋ ਮਹੀਨੇ ਮਿਨੀਮਮ ਤੁਸੀਂ ਮੰਨ ਕਿਸੇ ਨੂੰ ਡੇਢ ਪੰਤਾਲੀ ਦਿਨ ਚ ਆ ਜਾਂਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਮੈਨੂੰ ਕਾਲ ਕਰ ਲਿਓ ਇਸ ਨੰਬਰ ਤੇ ਜਾਂ ਮੈਂ ਕੋਈ ਹੋਰ ਵੀ ਚੱਕ ਸਕਦਾ ਫੋਨ ਤੇ ਤੁਹਾਨੂੰ ਦੱਸਦੇ ਨੇ ਕਿ ਤੁਹਾਨੂੰ ਮੋਬਾਈਲ ਨੰਬਰ ਈਮੇਲ ਐਡਰੈਸ ਜੋ ਵੀ ਤੁਸੀਂ ਉਹਨਾਂ ਵੱਲੋਂ ਕੰਟੈਕਟ ਕਰਨਾ ਹੋਵੇ ਤੁਸੀਂ ਠੀਕ ਐ ਜੀ ਥੈਂਕਯੂ ਜੀ